ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਹਾਂਜੀ ਹਾਂਜੀ ਕੀ ਗੱਲਬਾਤ ਹੋਈ ਹਾਂਜੀ ਨਹੀਂ ਕੀ ਹੋਇਆ ਕੀ ਹੈ ਸਰ ਅੱਛਾ ਅੱਛਾ ਸਵੇਰੇ ਤਾਂ ਮੈਂ ਠੀਕ ਭੇਜਿਆ ਸੀ ਤਾਂ ਹੁਣ ਕੀ ਹੋ ਗਿਆ ਅਚਾਨਕ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਇਹਦੇ ਪਾਪਾ ਨੂੰ ਭੇਜ ਦਿੰਦੀ ਹਾਂ ਓਕੇ